ਰਾਸ਼ਟਰੀ ਸੰਸਥਾਵਾਂ ਜਿਸ ਤੋਂ ਫੋਟੋਗ੍ਰਾਫ ਦੀ ਡਿਗਰੀ ਪ੍ਰਾਪਤ ਕਰ ਸਕਦੇ ਹਾਂ ਪਹਿਲੀ ਹੈ ਐਨ ਆਈ ਪੀ ਨੈਸ਼ਨਲ ਇੰਸਟੀਟਿਊਟ ਆਫ ਫੋਟੋਗਰਾਫੀ ਮੁੰਬਈ ਵਿੱਚ ਦੂਜੀ ਹੈ ਕ੍ਰੀਏਟਿਵਿਟੀ ਹਟ ਇੰਸਟੀਚਿਊਟ ਆਫ ਫੋਟੋਗ੍ਰਾਫੀ ਕੇਰਲਾ ਵਿੱਚ ਤੀਜੀ ਹੈ ਏਸ਼ੀਅਨ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਨੋਇਡਾ ਵਿੱਚ ਚੌਥੀ ਹੈ ਦਿੱਲੀ ਕਾਲਜ ਆਫ ਫੋਟੋਗ੍ਰਾਫੀ ਦਿੱਲੀ ਵਿੱਚ ਪੰਜਵੀਂ ਹੈ ਐਨ ਆਈ ਡੀ ਨੈਸ਼ਨਲ ਇੰਸਟੀਟਿਊਟ ਆਫ ਡਿਜਾਇਨ ਗਾਂਧੀ ਨਗਰ ਗੁਜਰਾਤ ਵਿੱਚ ਛੇਵੀਂ ਹੈ ਲਾਈਟ ਐਂਡ ਲਾਈਫ ਅਕੈਡਮੀ ਤਮਿਲਨਾਡੂ ਵਿੱਚ ਸੱਤਵੀਂ ਹੈ ਨਾਗਪੁਰ ਯੂਨੀਵਰਸਿਟੀ ਮਹਾਰਾਸ਼ਟਰਾ ਵਿੱਚ ਅੱਠਵੀਂ ਹੈ ਜਵਾਹਰ ਲਾਲ ਨਹਿਰੂ ਆਰਕੀਟੈਕਚਰ ਐਂਡ ਫਾਈਨ ਆਰਟਸ ਹੈਦਰਾਬਾਦ ਤੇਲੰਗਾਨਾ ਵਿੱਚ ਨੌਵੀਂ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਦਸਵੀਂ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੁਧਿਆਣੇ ਵਿੱਚ ਹੁਣ ਅੰਤਰਰਾਸ਼ਟਰੀ ਸੰਸਥਾਵਾਂ ਪਹਿਲੀ ਹੈ ਯੂਨੀਵਰਸਿਟੀ ਆਫ ਦਾ ਆਰਟ ਲੰਡਨ ਵਿੱਚ ਦੂਸਰੀ ਹੈ ਉਹੀਓ ਯੂਨੀਵਰਸਿਟੀ ਯੂਨਾਈਟਡ ਸਟੇਟ ਵਿੱਚ ਤੀਸਰੀ ਹੈ ਓਨਟੋਰੀਓ ਕਾਲਜ ਆਫ ਆਰਟ ਐਂਡ ਡਿਜ਼ਾਇਨ ਕੈਨੇਡਾ ਵਿੱਚ ਚੌਥੀ ਹੈ ਫੋਟੋਗ੍ਰਾਫੀ ਸਟੱਡੀਜ਼ ਕਾਲਜ ਆਸਟਰੇਲੀਆ ਵਿੱਚ ਪੰਜਵੀਂ ਹੈ ਯੈਲੋ ਯੂਨੀਵਰਸਿਟੀ ਨਿਊ ਹੈਵਨ ਯੂਨਾਈਟਡ ਸਟੇਟ ਵਿੱਚ ਛੇਵੀਂ ਹੈ ਸਕੂਲ ਆਫ ਵਿਜੂਅਲ ਆਰਟ ਨਿਊਯਾਰਕ ਸਿਟੀ ਯੂਨਾਈਟਡ ਸਟੇਟ ਵਿੱਚ ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਹਨ ਜਿੱਥੋਂ ਫੋਟੋਗ੍ਰਾਫ ਦੀ ਡਿਗਰੀ ਪ੍ਰਾਪਤ ਕਰ ਸਕਦੇ ਹਾਂ